ਸਰ ਮੇਰਾ ਨਾਮ ਭਾਰਤ ਭੂਸ਼ਣ ਪਿੰਡ ਮਿਰਜਾਪੁਰ ਦਾ ਰਹਿਣ ਵਾਲਾ ਜ਼ਿਲ੍ਹਾ ਪਠਾਨਕੋਟ ਅਤੇ ਜਿੱਦਾਂ ਪੁੱਛਿਆ ਗਿਆ ਕਿ ਔਰਤਾਂ ਬਾਰੇ ਔਰਤਾਂ ਸਾਡੇ ਪਠਾਨਕੋਟ ਦੇ ਵਿੱਚ ਕਾਫ਼ੀ ਜ਼ਿਆਦਾ ਕੰਮ ਕਰਦੀਆ ਹਨ ਘਰਾਂ ਵਿੱਚ ਵੀ ਕੰਮ ਕਰਦੀਆਂ ਹਨ ਆਫਿਸ ਦੇ ਵਿੱਚ ਵੀ ਕੰਮ ਕਰਦੀਆਂ ਹਨ ਅਤੇ ਕੰਮ ਕਰਨ ਲਈ ਬਾਹਰ ਕਨੇਡਾ ਵਗੈਰਾ ਵੀ ਗਈਆਂ ਹੋਈਆਂ ਹਨ ਅੰਮ੍ਰਿਤਸਰ ਜਲੰਧਰ ਕਾਫ਼ੀ ਜ਼ਿਆਦਾ ਏਜੰਸੀਆਂ ਹਨ ਜਿੱਥੇ ਸਾਡੀਆਂ ਭੈਣਾਂ ਅਤੇ ਬੀਬੀਆਂ ਕੰਮ ਕਰਦੀਆਂ ਹਨ ਅਤੇ ਸਾਡੇ ਪਠਾਨਕੋਟ ਵਿੱਚ ਵੀ ਕਾਫ਼ੀ ਭੈਣਾਂ ਜਿਹੜੀਆਂ ਕੰਪਿਊਟਰ ਦਾ ਕੰਮ ਕਰਦੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਅਤੇ ਫੈਕਟਰੀਆਂ ਦੇ ਵਿੱਚ ਵੀ ਸਾਡੀਆਂ ਭੈਣਾਂ ਜਿੱਦਾਂ ਜੇ ਐਡ ਕੇ ਹਿਮਾਚਲ ਦੇ ਵਿੱਚ ਹੀ ਜਾਂਦੀਆਂ ਅਤੇ ਸਾਡੇ ਇਲਾਕੇ ਦੇ ਵਿੱਚ ਤਾਂ ਇੱਦਾਂ ਦੀ ਕੋਈ ਗੱਲ ਨਹੀਂ ਆ ਕਿ ਉਹਨਾਂ ਦੀ ਕੋਈ ਰੁਕਾਵਟ ਨਹੀਂ ਹੈ ਕੰਮ ਕਰਨ ਦਿਓ ਸਾਰੇ ਸਾਰਿਆਂ ਨੂੰ ਖੁੱਲੀ ਦਿੱਤੀ ਗਈ ਹੈ ਪਰਿਵਾਰ ਵੱਲੋਂ ਵੀ ਸਰਕਾਰਾਂ ਵੱਲੋਂ ਵੀ ਕਿ ਕੰਮ ਕਰਨ ਅਤੇ ਕੋਈ ਰੁਕਾਵਟ ਨਹੀਂ ਹੈ ਕੇ ਹਜੇ ਤੱਕ ਤਾਂ ਜਦੋਂ ਤੋਂ ਮੈਂ ਦੇਖਿਆ ਹਜੇ ਤੱਕ ਦਾ ਕੋਈ ਇੱਦਾਂ ਦਾ ਕੇਸ ਨਹੀਂ ਆਇਆ ਕਿ ਕਿ ਭੈਣਾਂ ਨੂੰ ਜਾਂ ਜਨਾਨੀਆਂ ਨੂੰ ਘਰੋਂ ਕੰਮ ਕਰਨ ਨਾ ਜਾਂਦੇ ਤਾਂ ਜਾਵੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨ ਜਾਂਦੀਆਂ ਅਤੇ ਟਿਫਨ ਵਗੈਰਾ ਬੱਚਿਆਂ ਦੇ ਤਿਆਰ ਕਰਨੇ ਅਤੇ ਘਰ ਦਾ ਸਾਫ਼ ਸਫ਼ਾਈ ਘਰ ਦੇ ਬਰਤਨ ਬੁਰਤਨ ਜਾਂ ਘਰ ਦੇ ਸਾਂਭ ਸੰਭਾਲ ਜਨਾਨੀਆਂ ਹੀ ਕਰਦੀਆਂ ਆਈਆਂ ਅਤੇ ਅੱਗੇ ਵੀ ਕਰਨਗੀਆਂ ਇਹ ਹੀ ਆਸ ਹੈ ਅਤੇ ਜਨਾਨੀਆਂ ਸਾਡੇ ਇਲਾਕੇ ਦੀਆਂ ਅਤੇ ਜਿੱਦਾਂ ਦੁਕਾਨਾਂ 'ਤੇ ਵੀ ਕੰਮ ਕਰਦੀਆਂ ਹਨ ਖਿਡੋਣਿਆਂ ਆਲੀਆਂ ਦੁਕਾਨਾਂ ਹੋ ਗਈਆਂ ਜਾਂ ਫੋਟੋ ਸਟੇਟ ਵਗੈਰਾ ਦੀਆਂ ਦੁਕਾਨਾਂ 'ਤੇ ਜਨਾਨੀਆਂ ਕਾਫ਼ੀ ਹੱਦ ਤੱਕ ਕੰਮ ਕਰਦੀਆਂ ਨੇ ਅਤੇ ਕੰਮ ਕਰਨ ਲਈ ਅੰਮ੍ਰਿਤਸਰ ਜਲੰਧਰ ਵਗੈਰਾ ਵੀ ਜਾਂਦੀਆਂ ਨੇ ਧੰਨਵਾਦ ਜੀ